ਪੰਜਾਬੀ ਲੋਕ ਗੀਤਾਂ ਅਤੇ ਲੋਕ ਨਾਚਾਂ ਦਾ ਇੱਕ ਬਹੁਤ ਹੀ ਵਿਲੱਖਣ ਅਤੇ ਅਨਮੋਲ ਸੰਗ੍ਰਹਿ ਹੈ ਨੱਚਣਾ ਅਤੇ ਗਾਉਣਾ ਮੁੱਢ ਕੰਡਿਆਂ ਤੋਂ ਪੰਜਾਬੀਆਂ ਦੀ ਜਿੰਦ ਜਾਨ ਰਹੇ ਹਨ ਇਹ ਹੀ ਕਾਰਨ ਹੈ ਕਿ ਇਸ ਧਰਤੀ 'ਤੇ ਲੋਕ ਗੀਤਾਂ ਅਤੇ ਲੋਕ ਨਾਚਾਂ ਦੀ ਇੱਕ ਅਜਿਹੀ ਸ਼ੈਲੀ ਵਿਕਸਿਤ ਹੋਈ ਜਿਸ ਦੀ ਹਰ ਧੁੰਨ ਅਤੇ ਧਮਕ ਵਿੱਚੋਂ ਜ਼ਿੰਦਗੀ ਦਾ ਉਲਾਸ ਡੁੱਲ੍ਹ ਡੁੱਲ੍ਹ ਪੈਂਦਾ ਹੈ ਮਹਿਕ ਪੰਜਾਬ ਦੀ ਇਹਨਾਂ ਮਨੁੱਖੀ ਜਜ ਦਿਆਂ ਨੂੰ ਮੂਲ ਰੂਪ ਵਿੱਚ ਪਿਰੋਣ ਦਾ ਇੱਕ ਨਿਰਾਲਾ ਯਤਨ ਹੈ ਪੰਜਾਬੀ ਸੱਭਿਆਚਾਰ ਦੀ ਮਿੱਠੀ ਮਿੱਠੀ ਮਹਿਕ ਬਣਦੀ ਇਹ ਲੋਕ ਗੀਤਾਂ ਅਤੇ ਲੋਕ ਨਾਚਾਂ ਦਾ ਇੱਕ ਮਹਾਕੋਸ਼ ਹੈ ਜੋ ਹਰ ਵਰਗ ਦੇ ਪਾਠਕ ਦਾ ਭਰਪੂਰ ਮਨੋਰੰਜਨ ਕਰਦੇ ਹੋਏ ਆਉਣ ਵਾਲੀਆਂ ਪੀੜ੍ਹੀਆਂ ਦੀ ਸੰਦੀਵੀ ਮਾਰਗ ਦਰਸ਼ਨ ਕਰੇਗੀ ਲੋਕ ਗੀਤ ਦੇ ਨਾਲ ਹੀ ਇਸ ਰਾਹੀਂ ਪੰਜਾਬ ਲੋਕ ਗੀਤਾਂ ਦੇ ਭਾਤ ਸੁਵਾਤੇ ਰੂਪ ਜਿਵੇਂ ਗਿੱਧਾ ਭੰਗੜਾ ਵੱਲੋਂ ਆਦਿ ਇੰਝ ਚਿਤਰਿਤ ਕੀਤੇ ਹਨ ਕਿ ਪੜ੍ਹਨ ਵਾਲੇ ਦੀ ਅੱਡੀ ਥੜਕਣ ਲੱਗਦੀ ਹਾਂ ਪੰਜਾਬੀ ਪਹਿਰਾਵੇ ਅਤੇ ਲੋਕ ਸਾਜਾਂ ਦੀ ਵੀ ਵਿਸਥਿਤ ਰਲਕ ਦਿੱਤੀ ਗਈ ਹੈ